ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਹਿੰਦੂ ਮੁਸਲਿਮ ਸਿੱਖ ਇਸਾਈ ਹਰ ਨੂੰ ਆਪਣੇ ਹਰ ਇੱਕ ਨੂੰ ਆਪਣੇ ਧਰਮ ਮੰਨਣ ਦੀ ਆਜ਼ਾਦੀ ਆਪਣੇ ਇਸ਼ਟ ਪੂਜਣ ਦੀ ਆਜ਼ਾਦੀ ਹੈ ਅਤੇ ਸਾਡੇ ਪਿੰਡ ਵਿੱਚ ਗੁਰਦੁਆਰਾ ਸਾਹਿਬ ਹੈ ਜਿੱਥੇ ਮੈਂ ਸੁਬਹਾ ਅਤੇ ਸ਼ਾਮ ਪਾਠ ਕਰਦੀ ਹਾਂ ਜਾ ਕੇ ਸੁਬਹਾ ਜਪੁਜੀ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ ਅਤੇ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਅਤੇ ਉਹਨੂੰ ਸਿੱਖ ਸੰਗਤਾਂ 'ਚ ਵਰਤਾਇਆ ਜਾਂਦਾ ਅਤੇ ਸਾਡੇ ਪਿੰਡ ਵਿੱਚ ਇੱਕ ਧਾਰਮਿਕ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਬਾਰਾਂ ਦਿਨ ਠਹਿਰੇ ਸੀ ਉੱਥੇ ਜੋ ਜੰਡ ਸਾਹਿਬ ਨਾਲ ਉਹਨਾਂ ਨੇ ਆਪਣਾ ਘੋੜਾ ਬੰਨਿਆ ਸੀ ਉਹ ਵੀ ਉੱਥੇ ਮੌਜੂਦ ਹੈ ਉਸ ਸਥਾਨ ਦਾ ਨਾਮ ਹੈ ਰੋਹਲਾ ਸਾਹਿਬ ਉੱਥੇ ਅਸੀਂ ਹਰ ਮਹੀਨੇ ਜਾਂਦੇ ਹਾਂ ਅਤੇ ਤਿਥ ਤਿਉਹਾਰ ਹੋਵੇ ਉੱਥੇ ਮੱਸਿਆ ਦੇ ਮੇਲਾ ਲੱਗਦਾ ਅਤੇ ਉੱਥੇ ਜਾਂਦੇ ਹਾਂ ਉੱਥੇ ਬਹੁਤ ਵੱਡੀ ਪੱਧਰ 'ਤੇ ਮੇਲਾ ਲੱਗਦਾ ਹੈ ਅਤੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਹਨ ਅਤੇ ਉੱਥੇ ਮੱਥਾ ਟੇਕਦੀਆਂ ਹਨ ਅਤੇ ਧਾਰਮਿਕ ਸਥਾਨ ਦੇ ਦਰਸ਼ਨ ਕਰਦੀਆਂ ਹਨ ਉੱਥੇ ਇਸ਼ਨਾਨ ਘਰ ਬਣਿਆ ਹੋਇਆ ਹੈ ਤਲਾਬ ਬਣਿਆ ਹੋਇਆ ਹੈ ਜਿੱਥੇ ਇਸ਼ਨਾਨ ਕੀਤਾ ਜਾਂਦਾ ਹੈ ਅਤੇ ਸਮਝਿਆ ਜਾਂਦਾ ਹੈ ਕਿ ਉੱਥੇ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਤਲਵੰਡੀ ਸਾਬੋ ਸਾਡੇ ਇੱਕ ਨੇੜੇ ਧਾਰਮਿਕ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੀੜ ਤਿਆਰ ਕਰਵਾਈ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਉੱਥੇ ਵੀ ਸਾਡੇ ਸਿੱਖ ਸੰਗਤਾਂ ਜਾਂਦੀਆਂ ਹਨ ਅਤੇ ਬਹੁਤ ਵੱਡੇ ਪੱਧਰ 'ਤੇ ਮੇਲਾ ਲੱਗਦਾ ਹੈ ਬਠਿੰਡਾ ਜ਼ਿਲ੍ਹਾ ਜਿੱਥੇ ਕਿ ਸਾਡੇ ਮਤਲਬ ਕਿਲ੍ਹਾ ਮੁਬਾਰਕ ਆ ਜਿੱਥੇ ਗੁਰਦੁਆਰਾ ਸਾਹਿਬ ਆ ਅਤੇ ਉੱਥੇ ਚੌਵੀ ਘੰਟੇ ਲੰਗਰ ਲੱਗਦਾ ਹੈ ਗੁਰੂ ਦੇ ਪਾਠ ਚੱਲਦੇ ਹਨ ਅਤੇ ਉੱਥੇ ਸਿੱ ਹਰ ਕਾਸਟ ਦੇ ਹਰ ਰਿਜਲ ਰੀਜਨ ਦੇ